ਭਾਰਤ ਵਿੱਚ ਔਰਤਾਂ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਿਛਲੇ ਯੁੱਗਾਂ ਵਿੱਚ ਭਾਰਤ ਵਿੱਚ ਔਰਤਾਂ ਪ੍ਰਤੀ ਥੋੜ੍ਹੀ ਸੁਧਾਰ ਹੋਇਆ ਹੈ ਜਿਸ ਕਰਕੇ ਔਰਤ ਦਾ ਦਰਜਾ ਵੀ ਉੱਪਰ ਉੱਠਿਆ ਹੈ ਔਰਤ ਹਰੇਕ ਕੰਮਕਾਰ ਵਿੱਚ ਅੱਜ ਪੁਰਸ਼ ਦੇ ਬਰਾਬਰ ਖੜ੍ਹੀ ਹੈ ਪਰ ਫਿਰ ਵੀ ਕੁਛ ਸਮਾਜਿਕ ਤੱਤਵ ਇਹੇ ਜਿਹੇ ਹੈ ਜਿਹੜੇ ਔਰਤ ਨੂੰ ਪਛਾੜਨਾ ਚਾਹੁੰਦੇ ਹਨ ਉਨ੍ਹਾਂ ਦਾ ਹਰ ਟੈਮ ਇਹੀ ਜ਼ੋਰ ਲੱਗਦਾ ਵੀ ਔਰਤਾਂ ਨੂੰ ਪਿੱਛੇ ਧੱਕਿਆ ਜਾਵੇ ਪਰ ਔਰਤ ਅੱਜ ਸਿੱਖਿਆ ਦੇ ਵਿੱਚ ਬਰਾਬਰ ਦੀ ਦਾਅਵੇਦਾਰ ਹੈ ਔਰਤ ਵੀ ਨੂੰ ਕੋਈ ਕੰਮ ਇਹੇ ਜਿਹਾ ਨਹੀਂ ਜਿਹੜਾ ਨਹੀਂ ਆਉਂਦਾ ਔਰਤ ਅੱਜ ਦੇ ਟੈਮ ਵਿੱਚ ਫਿਰ ਵੀ ਸ ਥੋੜ੍ਹਾ ਸੁਰੱਖਿਆ ਮਹਿਸੂਸ ਕਰ ਰਹੀ ਹੈ ਫਿਰ ਵੀ ਕੁਛ ਨਾ ਕੁਛ ਸੁਧਾਰ ਕਰਨ ਦੀ ਜ਼ਰੂਰਤ ਹੈ ਜੋ ਕਿ ਭਾਰਤ ਸਰਕਾਰ ਨੂੰ ਕਦਮ ਉਠਾਉਣੇ ਚਾਹੀਦੇ ਹਨ ਵੀ ਔਰਤਾਂ ਦੀ ਸੁਰੱਖਿਆ ਪ੍ਰਤੀ ਦੇਖੋ ਇਹ ਸਰਕਾਰਾਂ ਦੇ ਕੰਮ ਹੁੰਦੇ ਵੀ ਭਾਰਤ ਵਿੱਚ ਔਰਤ ਦੀ ਸਥਿਤੀ ਕੀ ਹੈ ਪੁਰਸ਼ ਦੀ ਕੀ ਸਥਿਤੀ ਹੈ ਪਿਛਲੇ ਦਹਾਕਿਆਂ ਵਿੱਚ ਔਰਤ ਦੀ ਸਥਿਤੀ ਹੁਣ ਦੇ ਮੁਕਾਬਲੇ ਬਹੁਤ ਚੰਗੀ ਹੁਣ ਦੇ ਮੁਕਾਬਲੇ ਚੰਗੀ ਹੈ ਭਾਰਤ ਵਿੱਚ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ ਜੋ ਕਿ ਇਸ ਵਿੱਚ ਮਹਿਫੂਜ਼ ਤ ਮਹਿਸੂਸ ਕਰ ਰਹੀ ਹੈ ਭਾਰਤ ਵਿੱਚ ਔਰਤਾਂ ਹਰੇਕ ਕੰਮ ਵਿੱਚ ਅੱਗੇ ਹਨ ਜੋ ਕਿ ਪੁਰਸ਼ ਦੇ ਬਰਾਬਰ ਦਾ ਮੁਕਾਬਲਾ ਕਰਦੀਆਂ ਹਨ ਔਰ ਸਿੱਖਿਆ ਵਿੱਚ ਵੀ ਅੱਜ ਔਰਤ ਬਰਾਬਰ ਦੀ ਦਾਅਵੇਦਾਰ ਕਹਾਉਂਦੀ ਹੈ